ਹਾਂਜੀ ਪਹਿਲਾਂ ਸਿੱਖਣ ਤੋਂ ਪਹਿਲਾਂ ਪਲੀਸ ਆਪਣੇ ਇਨਸ਼ਟਰਕਟਰ ਦੀਆਂ ਉਹਦੇ ਨਾਲ ਗਾਈਡਲਾਈਨ ਫੋਲੋ ਕਰੇ ਠੀਕ ਹੈ ਅਤੇ ਪਹਿਲਾਂ ਘੱਟ ਪਾਣੀ 'ਚ ਜਾਵੇ ਇਹ ਨਹੀਂ ਵੀ ਪਹਿਲਾਂ ਸਿੱਧਾ ਡੀਪਲੀ ਪਾਣੀ 'ਚ ਚਲੇ ਜਾਵੇ ਅਤੇ ਇਨਸਟਕਰਸ਼ਨ ਨੂੰ ਜ਼ਰੂਰ ਫੋਲੋ ਕਰੇ ਬਿਕੋਜ਼ ਇਹ ਬਹੁਤ ਇਮਪੋਰਟੈਂਟ ਹੈ